ਸਾਡੇ ਸਕੂਲ ਵਿੱਚ ਬਹੁਤ ਹੀ ਸੁੰਦਰ ਲਾਇਬ੍ਰੇਰੀ ਹੈ ਜਿਸ ਵਿੱਚ ਬਹੁਤ ਸਾਰੀਆਂ ਭਿੰਨ ਭਿੰਨ ਪ੍ਰਕਾਰ ਦੇ ਵਿਸ਼ਿਆਂ ਸੰਬੰਧੀ ਕਿਤਾਬਾਂ ਮੌਜੂਦ ਹਨ ਅਤੇ ਵਿਦਿਆਰਥੀ ਆਪਣੀ ਜ਼ਰੂਰਤਾਂ ਦੇ ਅਨੁਸਾਰ ਉਨ੍ਹਾਂ ਕਿਤਾਬਾਂ ਨੂੰ ਆਸਾਨੀ ਨਾਲ ਇਸ਼ੂ ਕਰਵਾ ਸਕਦੇ ਹਨ ਅਤੇ ਇਸ ਇਸ ਨਾਲ ਵਿਦਿਆਰਥੀ ਆਪਣੇ ਗਿਆਨ ਅਤੇ ਆਪਣੀ ਸੋਚ ਵਿੱਚ ਵਾਧਾ ਕਰ ਸਕਦਾ ਹੈ ਅਤੇ ਵਿਦਿਆਰਥੀ ਭਿੰਨ ਭਿੰਨ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ ਹਰੇਕ ਸਕੂਲ ਵਿੱਚ ਲਾਇਬ੍ਰੇਰੀ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਤਾਂ ਕਿ ਵਿਦਿਆਰਥੀ ਆਪਣੇ ਵਿਹਲੇ ਸਮੇਂ ਵਿੱਚ ਲਾਇਬ੍ਰੇਰੀ ਵਿੱਚ ਆਪਣਾ ਸਮਾਂ ਬਿਤਾ ਸਕੇ ਤਾਂ ਜੋ ਉਹ ਕਿਤਾਬਾਂ ਅਤੇ ਆਪਣੇ ਸਿੱਖਿਆ ਨਾਲ ਹੋਰ ਜੁੜ ਸਕੇ ਉਹ ਆਪਣੀ ਵਿਦਿਆਰਥੀ ਲਾਇਬ੍ਰੇਰੀ ਵਿੱਚ ਬਹਿ ਕੇ ਆਪਣਾ ਧਿਆਨ ਕਿਤਾਬਾਂ ਵੱਲ ਕੇਂਦਰਿਤ ਕਰ ਸਕਦਾ ਹੈ ਅਤੇ ਆਪਣੀ ਸਿੱਖਿਆ ਵਿੱਚ ਵਾਧਾ ਕਰ ਸਕਦਾ ਹੈ ਬਚਪਨ ਵਿੱਚ ਜੋ ਮੈਂ ਕਿਤਾਬਾਂ ਪੜ੍ਹੀਆਂ ਉਹ ਬਹੁਤ ਹੀ ਦਿਲਚਸਪ ਸਨ ਅਤੇ ਜਿਨ੍ਹਾਂ ਦਾ ਮੇਰੇ ਜੀਵਨ ਉੱਤੇ ਬਹੁਤ ਹੀ ਜ਼ਿਆਦਾ ਪ੍ਰਭਾਵ ਪਿਆ ਇਹ ਕਿਤਾਬਾਂ ਜ਼ਿਆਦਾਤਰ ਕਿੱਸੇ ਕਹਾਣੀਆਂ ਅਤੇ ਵਿਅੰਗਆਤਮਿਕ ਗੱਲਾਂ ਬਾਰੇ ਹੁੰਦੀਆਂ ਸਨ ਜੋ ਕਿ ਮੈਂ ਆਪਣੇ ਦੋਸਤਾਂ ਮਿੱਤਰਾਂ ਨਾਲ਼ ਬੈਠ ਕੇ ਪੜ੍ਹੀਆਂ ਅਤੇ ਜਿਨ੍ਹਾਂ ਨਾਲ ਮੇਰੇ ਜੀਵਨ ਉੱਤੇ ਬਹੁਤ ਹੀ ਜ਼ਿਆਦਾ ਅਸਰ ਹੋਇਆ